ਹਾਂਜੀ ਵਧੀ ਵਧੀਆ ਵਧੀਆ ਵੀਰੇ ਤੁਸੀਂ ਦੱਸੋ

ਅੱਛਾ ਅੱਛਾ ਕਿੱਥੋਂ ਸ਼ਿਫਟ ਹੋਏ ਹੋ ਅੱਛਾ ਕੀ ਕੰਮ ਕੀ ਕਰਦੇ ਸੀ ਉੱਧਰ ਅੱਛਾ ਅੱਛਾ ਇੱਧਰ ਕਿਹੜੀ ਕੰਪਨੀ 'ਚ ਜੋਬ ਲੱਗ ਗਈ ਤੁਹਾਡੀ ਅੱਛਾ ਜੇ ਕੇ ਸੀਮੈਟ ਉਹ ਵਧੀਆ ਕੰਪਨੀ ਹੈ ਵੈਸੇ ਕਾਫ਼ੀ ਨਾਲੇ ਕੀ ਹੋ ਮਾਰਕੀਟ ਐ ਐਡਵਾਈਜ਼ਰ ਹੋ ਅੱਛਾ ਅਤੇ ਹੁਣ ਪ੍ਰੋਬਲਮ ਕੋਈ ਹੈ ਤਾਂ ਨਹੀਂ ਨਾ

ਅੱਛਾ ਰਾਸ਼ਨ ਰੂਸ਼ਨ ਲੈਣਾ ਸੀ ਆਹ ਯਾਰ ਤੁਸੀਂ ਨਾ ਇੱਧਰੋ ਕਟਾਰੀਆ ਬੇਕਰੀ ਤੋਂ ਵੀ ਲੈ ਸਕਦੇ ਹੋ ਜਿਵੇਂ ਕੋਈ ਕੇਕ ਕੂਕ ਲੈਣਾ ਨਾ ਕੋਹਲੀ ਸਵੀਟ ਤੋਂ ਲੈ ਸਕਦੇ ਹੋ ਜਿਵੇਂ ਡੈਅਰੀ ਪ੍ਰੋਡਕਟ ਲੈਣੇ ਨੇ ਵਨ ਲੱਕੀ ਹੋ ਗਿਆ ਇਹ ਡੈਅਰੀ ਵਗੈਰਾ ਨਾ ਲੋਕਲੀ ਹੈਗੀ ਕੋਲ ਤੁਸੀਂ ਨਾ ਉੱਧਰੋਂ ਲੈ ਲਿਓ ਉੱਧਰੋਂ ਲੈ ਲੈਣਾ ਹਾਂਜੀ ਅਤੇ ਕੋਈ ਅਤੇ ਕੋਈ ਰੈਸਟੋਰੈਂਟ ਵਗੈਰਾ ਪੁੱਛਣਾ ਪੁੱਛਣਾ ਹੋਵੇ ਤਾਂ ਦੱਸੋ ਆਹ ਨਾ ਤੁਸੀਂ ਨਾ ਬਾਈ ਨੰਬਰ ਜਾ ਸਕਦੇ ਹੋ ਉੱਧਰ ਨਾ ਇੱਕ ਜੱਗੀ ਸਵੀਟ ਹੈਗਾ ਬਹੁਤ ਵਧੀਆ ਖਾਣਾ ਉੱਧਰ ਦਾ ਅਤੇ ਉਹ ਨਾ ਡਾਈਨਿੰਗ ਵੀ ਬਹੁਤ ਵਧੀਆ ਕੀਤਾ ਹੋਇਆ ਡੈਕੋਰੇਸ਼ਨ ਵਗੈਰਾ ਵੀ ਪਾਰਟੀ ਹੋਲ ਸਭ ਕੁਛ ਬੜਾ ਵਧੀਆ ਉੱਧਰ ਦਾ ਤੁਸੀਂ ਉੱਧਰ ਜਾ ਸਕਦੇ ਹੋ ਹਾਂਜੀ ਅਤੇ ਉਹ ਕੱਪੜੇ ਵਗੈਰਾ ਲਈ ਨਾ ਸੰਡੇ ਮਾਰਕੀਟ ਜਾ ਸਕਦੇ ਹੋ ਕਿਲ੍ਹਾ ਚੌਂਕ ਵਗੈਰਾ ਉੱਧਰ ਸਸਤੇ ਮਿਲ ਜਾਣਗੇ ਨਾਲੇ ਕੁਆਲਟੀ ਵੀ ਕਾਫ਼ੀ ਵਧੀਆ ਹੋਵੇਗੀ ਕੱਪੜਿਆਂ ਦੀ ਹਾਂਜੀ ਹੋਰ ਦੱਸੋ ਕਿਵੇਂ ਹੋ ਕਿਆ ਕੋਈ ਬਾਈਕ ਬੂਈਕ ਅੱਛਾ ਜੀ ਆ ਜੀਤ ਹੈ ਨਾ ਇਹ ਨਾ ਜੀਤ ਨਾ ਇੱਕ ਸਨਫਲਾਵਰ ਨਾ ਸਕੂਲ ਹੈ ਉੱਧਰ ਉੱਧਰ ਨਾ ਜਮਾ ਹੀ ਨਾਲ ਹੈ ਜੀਤ ਬੈਕਰੀ ਉਹਦੇ ਅਤੇ ਨਾ ਉੱਧਰ ਹਾਂਜੀ ਉਹ ਕੋਹਲੀ ਸਵੀਟ ਵੀ ਉਹ ਦੇ ਨਾ ਹਲਕਾ ਜਿਹਾ ਅੱਗੇ ਜਾ ਕੇ ਹੀ ਹੈ ਅਤੇ ਨਾ ਉਹ ਵੀਹ ਪੱਚੀ ਸਾਲਾਂ ਤੋਂ ਨਾ ਇੱਧਰ ਹੀ ਹੈ ਨਾਲੇ ਕਾਫ਼ੀ ਨਾਂ ਵੀ ਬਣਿਆ ਵਾ ਉੱਧਰ ਦਾ ਅਤੇ ਨਾਲੇ ਸਮਾਨ ਵੀ ਬਹੁਤ ਵਧੀਆ ਹੁੰਦਾ ਉਸ ਦਾ ਉੱਧਰ ਦਾ ਹਾਂਜੀ ਹੋਰ ਅੱਛਾ ਹੋਰ ਫਿਰ ਹਾਂਜੀ ਹਾਂਜੀ ਓਕੇ ਹਾਂਜੀ ਕੋਈ ਨਹੀਂ ਕੋਈ ਨਹੀਂ ਆਪਾਂ ਚਲਦੇ ਹੈ ਫਿਰ ਕਿਤੇ ਫਿਰ